ਮੈਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਕਦਰ ਕਰਦੀ ਹਾਂ ਉਹ ਰਿਸ਼ਤਿਆਂ ਵੀ ਕਰਦੀ ਹਾਂ ਮੇਰਾ ਇੱਕ ਅਸੂਲ ਹੈ ਕਿ ਰਿਸ਼ਤੇਦਾਰ ਭਾਵੇਂ ਗਰੀਬ ਹੋਵੇ ਭਾਵੇਂ ਰਿਸ਼ਤੇਦਾਰ ਅਮੀਰ ਹੋਵੇ ਮੈਂ ਸਭ ਨੂੰ ਇੱਕੋ ਜਿਹਾ ਹੀ ਜਿਹੜਾ ਹੈ ਟਰੀਟ ਕਰਦੀ ਹਾਂ ਮੈਂ ਇਹ ਹੋ ਸਕਦਾ ਵੀ ਗਰੀਬ ਰਿਸ਼ਤੇਦਾਰ ਨੂੰ ਜ਼ਿਆਦਾ ਵਧੀਆ ਟਰੀਟ ਕਰ ਲਵਾਂ ਅਮੀਰ ਨਾਲੋਂ ਵੀ ਕਿਉਂਕਿ ਮੈਨੂੰ ਇਹ ਹੁੰਦਾ ਵੀ ਅਮੀਰ ਨਾਲ ਤਾਂ ਹਰੇਕ ਬੰਦਾ ਵਰਤਣਾ ਹੀ ਚਾਹੁੰਦਾ ਜੇ ਤੁਸੀਂ ਗਰੀਬ ਨਾਲ ਵੀ ਵਰਤੋਂਗੇ ਤਾਂ ਉਹ ਜ਼ਿਆਦਾ ਵਧੀਆ ਹੈ ਇਹ ਚੀਜ਼ ਤੁਹਾਡੀ ਰੱਬ ਦੇਖਦਾ ਹੈ ਇਸ ਲਈ ਮੈਂ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਨਾ ਰਿਸ਼ਤਿਆਂ ਦੀ ਕਦਰ ਕਰਦੀ ਹਾਂ ਜੇ ਰਿਸ਼ਤੇ ਨਹੀਂ ਹੈਗੇ ਤਾਂ ਪੈਸਾ ਵੀ ਕੁਛ ਨਹੀਂ ਹੈਗਾ ਭਾਵੇਂ ਤੁਸੀਂ ਲੱਖਾਂ ਹੀ ਪੈਸੇ ਕਮਾ ਲਓ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਚੰਗੇ ਰਿਸ਼ਤੇ ਨਹੀਂ ਕਮਾਏ ਹੈਗੇ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਕੁਛ ਨਹੀਂ ਕਮਾਇਆ ਹੈਗਾ ਕਿਉਂਕਿ ਜਿਹੜੇ ਰਿਸ਼ਤੇ ਹੈ ਜਿਹੜੇ ਔਖੇ ਵੇਲੇ ਤੁਹਾਡੇ ਕੰਮ ਆ ਜਾਣ ਉਹੀ ਰਿਸ਼ਤੇ ਤੁਹਾਡੇ ਸਭ ਤੋਂ ਵਧੀਆ ਰਿਸ਼ਤੇ ਨੇ ਕਿਉਂਕਿ ਸੁੱਖ ਦੇ ਵਿੱਚ ਤਾਂ ਹਰ ਬੰਦਾ ਆ ਕੇ ਖੜਾ ਹੋ ਜਾਂਦਾ ਜਦੋਂ ਤੁਸੀਂ ਦੁੱਖ ਟਾਈਮ ਹੋ ਅਤੇ ਉਸ ਟਾਈਮ ਤੁਹਾਡੇ ਕੋਲ ਆ ਕੇ ਜਿਹੜਾ ਤੁਹਾਡਾ ਹਾਲ ਪੁੱਛਦਾ ਹੈ ਉਹੀ ਤੁਹਾਡਾ ਸਭ ਤੋਂ ਵਧੀਆ ਰਿਸ਼ਤੇਦਾਰ ਹਾਂ ਅਤੇ ਇਸ ਲਈ ਮੈਂ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਸਭ ਤੋਂ ਵੱਧ ਕਦਰ ਕਰਦੀ ਹਾਂ